ਪਟਰੋਲ ਦੀ ਵਧੀਆਂ ਹੋਈਆਂ ਕੀਮਤਾਂ ਦਾ ਸਾਡੇ 'ਤੇ ਬਹੁਤ ਪ੍ਰਭਾਵ ਪਿਆ ਹੈ ਪਹਿਲਾਂ ਮੈਂ ਸ ਆਪਣਾ ਐਕਟੀਵਾ 'ਤੇ ਆਪਣੇ ਕੰਮ ਤੇ ਜਾਂਦਾ ਸਾਂ ਪਰ ਉਸ ਦੇ ਵਿੱਚ ਮੇਰਾ ਪਟਰੋਲ ਬਹੁਤ ਜ਼ਿਆਦਾ ਲੱਗਦਾ ਸੀ ਕਿਉਂਕਿ ਮੇਰਾ ਰੋਜ਼ ਦਾ ਮੇਰਾ ਦਫਤਰ ਮੇਰੇ ਘਰ ਤੋਂ ਸੱਤ ਅਤੇ ਅੱਠ ਕਿਲੋਮੀਟਰ ਦੂਰ ਹੈ ਲੇਕਿਨ ਪਹਿਲੇ ਰਾਜ਼ੀ ਕੇ ਪਟਰੋਲ ਸਸਤਾ ਹੁੰਦਾ ਸੀ ਅਤੇ ਕੋਈ ਪਰਵਾਹ ਨਹੀਂ ਸੀ ਅਸੀਂ ਚਲ ਜਾਈਦਾ ਹੀ ਸੀ ਲੇਕਿਨ ਹੁਣ ਸੋਚੀਦਾ ਕਿ ਫਾਲਤੂ ਇੱਧਰ ਉੱਧਰ ਸ ਸਕੂਟਰ ਲੈ ਕੇ ਨਹੀਂ ਜਾਈਦਾ ਕਿਉਂਕਿ ਸਕੂਟਰ ਲੈ ਕੇ ਜਾਣ ਨਾਲ ਜ਼ਰਾ ਜਾ ਵੀ ਇੱਧਰ ਉੱਧਰ ਜਾਈਏ ਅਤੇ ਪਟਰੋਲ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਹੁਣ ਕੋਸ਼ਿਸ਼ ਕਰੀ ਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਹੁਣ ਅਸੀਂ ਕੋਈ ਘਰ ਦੇ ਕੋਲ ਕੋਈ ਕੰਮ ਹੋਵੇ ਅਤੇ ਪੈਦਲ ਹੀ ਚਲੇ ਜਾਈਦਾ ਹੈ ਔਰ ਪੈਦਲ ਹੀ ਆ ਜਾਈਦਾ ਹੈ ਕਈ ਵਰੀ ਹੁਣ ਸੋਚੀਦਾ ਕੇ ਯਾਰ ਪਟਰੋਲ 'ਤੇ ਘੱਟਦਾ ਹੀ ਨਹੀਂ ਹੈਗਾ ਪਰ ਹੁਣ ਕਈ ਵਰੀ ਹੁਣ ਸੋਚੀਦਾ ਹੈ ਕਿ ਚਲੋ ਪੈਦਲ ਹੀ ਚਲ ਜੀਏ ਵੀ ਕੁਝ ਇਸ ਤਰ੍ਹਾਂ ਮੈਂ ਸੋਚਾ ਕਿ ਚਲੋ ਅੱਜ ਆਪਣੇ ਕੰਮ 'ਤੇ ਪੈਦਲ ਹੀ ਚਲੇ ਦਿੱਤਾ ਜਾਵੇ ਫੇਰ ਮੈਂ ਪੈਦਲ ਚਲਾ ਗਿਆ ਅਤੇ ਇੱਕ ਤਰ੍ਹਾਂ ਦੀ ਇੱਕ ਵੋਕ ਹੋ ਗਈ ਔਰ ਨਾਲੇ ਆਪਣੀ ਸਿਹਤ ਵੀ ਸਹੀ ਰਹੀ ਔਰ ਬੰਦੇ ਦਾ ਸਰੀਰ ਫਿਟ ਰਹਿੰਦਾ ਹੈ ਹੁਣ ਪਟਰੋਲ ਦੇ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ ਤੁਸੀਂ ਦੇਖਦੇ ਹੋ ਕਿ ਕਈ ਵਾਰੀ ਪੋਲਿਊਸ਼ਨ ਦੇ ਕਾਰਨ ਲੋਕਾਂ ਦੀ ਬਿਮਾਰੀਆਂ ਵੱਧਦੀਆਂ ਜਾਂਦੀਆਂ ਹਨ ਔਰ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ ਅਤੇ ਪਟਰੋਲ ਦੇ ਕਾਰਨ ਪਟਰੋਲ ਦੇ ਕਾਰਨ ਹੀ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਧੂੰਆਂ ਬੜਾ ਉੱਡਦਾ ਹੈ ਜਿਹਦੇ ਕਾਰਨ ਗਰਮੀਆਂ 'ਚ ਤੁਸੀਂ ਦੇਖਦੇ ਹੋ ਕਿ ਪੋਲਿਊਸ਼ਨ ਦੇ ਕਾਰਨ ਗਰਮੀ ਜ਼ਿਆਦਾ ਵੱਧ ਜਾਂਦੀ ਹੈ ਔਰ ਅਗਰ ਪੋਲਿਊਸ਼ਨ ਨਾ ਹੋਵੇ ਅਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਵੇ ਔਰ ਗਰਮੀ ਜਿਹੜੀ ਹੈ ਘੱਟ ਜਾਵੇ ਲੇਕਿਨ ਪਟਰੋਲ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਹੈ ਅਸੀਂ ਸੋਚੀਦਾ ਕਿ ਯਾਰ ਕੀ ਕਰੀਏ ਹੁਣ ਅੱਜ ਕੱਲ੍ਹ ਇਲੈਕਟ੍ਰਿਕ ਦਾ ਵੀ ਜ਼ਮਾਨਾ ਆ ਗਿਆ ਵਾ ਅੱਜ ਕੱਲ੍ਹ ਲੋਕ ਇਲੈਕਟ੍ਰਿਕ ਵਾਈਕਲ ਲੈਣਾ ਸ਼ੁਰੂ ਹੋ ਗਏ ਨੇ ਹੁਣ ਅਤੇ ਹੁਣ ਇਲੈਕਟ੍ਰਿਕ ਵਾਈਕਲ ਕਾਫੀ ਚੱਲਣ ਲੱਗ ਪਏ ਨੇ ਉਹਦੇ ਵਿੱਚ ਇਹ ਹੈਗਾ ਹੈ ਕਿ ਪੋਲਿਊਸ਼ਨ ਦਾ ਕਾਫੀ ਫਰਕ ਪੈ ਰਿਹਾ ਹੈ ਲੇਕਿਨ ਗੌਰਮਿੰਟ ਇਹਦੀ ਕੀਮਤਾਂ ਬਾਰੇ ਹਾਲੇ ਕੁਛ ਵੀ ਨਹੀਂ ਸੋਚ ਰਹੀ ਅਤੇ ਗੌਰਮਿੰਟ ਨੂੰ ਸੋਚਨਾ ਚਾਹੀਦਾ ਕਿ ਪਟਰੋਲ ਦਾ ਥੋੜ੍ਹਾ ਰੇਟ ਘਟਾਇਆ ਜਾਵੇ ਜਿਹਦੇ ਕਾਰਨ ਕਿ ਜਿਹਦੇ ਬੰਦੇ ਜਿਸ ਤਰ੍ਹਾਂ ਮੈਂ ਇੱਕ ਨੌਕਰੀ ਕਰਨਾ ਵਾਂ ਨੌਕਰੀ ਕਰਨ ਬੰਦੇ ਨੂੰ ਕਰਨ ਵਾਲੇ ਬੰਦੇ ਨੂੰ ਥੋੜ੍ਹਾ ਜਿਹਾ ਰਾਹਤ ਮਿਲ ਸਕੇ